ਸਾਡੇ ਪੰਜਾਬ ਵਿੱਚ ਵੱਖ ਵੱਖ ਮੌਸਮਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਫਸਲਾਂ ਉਗਾਈ ਜਾਂਦੀਆ ਪੰਜਾਬ ਵਿੱਚ ਵੀ ਨਹੀਂ ਹਰ ਜਗ੍ਹਾ 'ਤੇ ਵੱਖ ਵੱਖ ਮੌਸਮਾਂ ਵਿੱਚ ਵੱਖ ਵੱਖ ਤਰ੍ਹਾਂ ਦੀ ਫਸਲਾਂ ਉੱਗਦੀਆਂ ਹਨ ਜਿੱਦਾਂ ਸਰਦੀਆਂ ਵਿੱਚ ਝੋਨਾ ਉਗਾਉਂਦੇ ਹਨ ਗਰਮੀਆਂ ਵਿੱਚ ਉਹ ਬਸੰਤ ਵਾਲੇ ਦਿਨ ਕਣਕ ਨੂੰ ਵੱਢਦੇ ਹਨ ਅਤੇ ਇਹ ਹੀ ਚੀਜ਼ਾਂ ਤਿਉਹਾਰ ਵਿੱਚ ਆ ਜਾਂਦੀਆਂ ਹਨ ਸਾਡਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਹਰ ਚੀਜ਼ ਨੂੰ ਇੱਕ ਤਿਉਹਾਰ ਦੇ ਤੌਰ 'ਤੇ ਵੇਖਿਆ ਜਾਂਦਾ ਹੈ ਜਿਸ ਤਰ੍ਹਾਂ ਹੁਣ ਕਣਕ ਕਣਕ ਜਿਹੜੀ ਹੈ ਉਹ ਰੋਟੀ ਲਈ ਇਸਤੇਮਾਲ ਹੁੰਦੀ ਹੈ ਅਤੇ ਉਹਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਇਸ ਕਰਕੇ ਉਹਦਾ ਵੱਡੇ ਲੈਵਲ 'ਤੇ ਪੱਧਰ ਹੈਗਾ ਉਹਨੂੰ ਕਾਫ਼ੀ ਜਗ੍ਹਾ 'ਤੇ ਉਹਨੂੰ ਉਗਾਇਆ ਜਾਂਦਾ ਹੈ ਅਤੇ ਉਹਨੂੰ ਕਾਫ਼ੀ ਟਾਈਮ ਲੱਗਦਾ ਉਗਾਉਂਦੇ ਵੀ ਟਾਈਮ ਲੱਗਦਾ ਹੈ ਉਹ ਕਿਉਂਕਿ ਜਦੋਂ ਤਿਆਰ ਹੁੰਦੀ ਹੈ ਤਾਂ ਬਸੰ ਦਾ ਲਾ ਬਸੰਤ ਵਾਲੇ ਦਿਨ ਉਹਨੂੰ ਫਿਰ ਕੱਟਦੇ ਹਨ ਅਤੇ ਉਹਨੂੰ ਫਿਰ ਹੁੰਦਾ ਉਹਨਾਂ ਦਾ ਕੋਈ ਰਿਵਾ ਰਿਵਾਜ਼ ਹੈ ਕੀ ਪੰ ਕੁਛ ਕਰਦੇ ਹਨ ਅਤੇ ਫਿਰ ਉਹਨੂੰ ਕੱਟ ਕੇ ਫਿਰ ਉਹ ਮੇਰੇ ਖਿਆਲ ਨਾਲ ਭੋਗ ਭੁਗ ਭੋਗ ਭੁਗ ਲਵਾਉਂਦੇ ਹਨ ਭੋਗ ਲਗਵਾ ਕੇ ਉਹਨੂੰ ਚੜਾਉਂਦੇ ਹਨ ਚੜ੍ਹਾ ਕੇ ਉਹਨੂੰ ਜਿਹੜੇ ਆਮ ਲੋਕਾਂ ਲਈ ਵੇਚ ਦਿੱਤਾ ਜਾਂਦਾ ਹੈ ਇਸ ਕਰਕੇ ਹਰ ਦੇਸ਼ ਵਿੱਚ ਉਹਦੇ ਮੌਸਮਾਂ ਦੇ ਹਿਸਾਬ ਨਾਲ ਫਸਲਾਂ ਉੱਗਦੀਆਂ ਹੋਰ ਵੀ ਫਸਲਾਂ ਜਿਹੜੀਆਂ ਮੌਸਮ ਦੇ ਹਿਸਾਬ ਨਾਲ ਉੱਗਦੀਆਂ ਹਨ ਹ ਇਹ ਨਹੀਂ ਕਿ ਸਿਰਫ਼ ਝੋਨਾ ਕਣਕ ਇਹ ਹੀ ਚੀਜ਼ਾਂ ਉੱਗਦੀਆਂ ਹਰ ਤਰ੍ਹਾਂ ਦੀ ਫਸਲਾਂ ਉੱਗਦੀਆਂ ਹਨ ਹਰ ਹਰ ਇੱਕ ਮੌਸਮ ਜਿੱਦਾਂ ਸਰਦੀ ਦਾ ਮੌਸਮ ਪੱਤਝੜ ਦਾ ਮੌਸਮ ਹੋਰ ਠੰਡ ਦਾ ਮੌਸਮ ਮੀਂਹ ਪੈ ਜਾਂਦਾ ਆ ਹੋਰ ਵੱਖ ਵੱਖ ਤਰ੍ਹਾਂ ਦੇ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਉੱਗਦੀਆਂ ਹਨ